ਛੱਬੀ ਅਗਸਤ ਉੱਨੀ ਸੌ ਸੰਤਾਲੀ ਸੋਲਾਂ ਮਈ ਉੱਨੀ ਸੌ ਅੱਸੀ ਇੱਕ ਜੂਨ ਉੱਨੀ ਸੌ ਚੁਰਾਸੀ ਇਕੱਤੀ ਦਸੰਬਰ ਦੋ ਹਜ਼ਾਰ ਇਕੱਤੀ ਮਾਰਚ ਦੋ ਹਜ਼ਾਰ ਤਿੰਨ